ਐੱਲ ਪੀ ਜੀ ਸਿਲੰਡਰ ਹੁਣ ਹਰ ਘਰ ਵਿੱਚ ਵਰਤਿਆ ਜਾਂਦਾ ਹੈ ਹਰ ਘਰ ਦੀ ਲੋੜ ਹੈ ਇਸ ਤੋਂ ਵਗੈਰ ਹੁਣ ਗੁਜ਼ਾਰਾ ਨਹੀਂ ਹੋ ਸਕਦਾ ਪਹਿਲਾਂ ਲੋਕ ਲੱਕੜਾਂ 'ਤੇ ਖਾਣਾ ਬਣਾਉਂਦੇ ਸੀ ਉਹਨਾਂ ਦੇ ਨੁਕਸਾਨ ਘੱਟ ਹੀ ਹੁੰਦੇ ਸਨ ਪਰ ਹੁਣ ਐੱਲ ਪੀ ਜੀ ਸਲੰਡਰ ਦੀ ਵਰਤੋਂ ਬਹੁਤ ਹੀ ਧਿਆਨ ਨਾਲ ਕਰਨੀ ਪੈਂਦੀ ਹੈ ਇਸ ਦੀ ਵਰਤੋਂ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣੀਆਂ ਚਾਹੀਦੀਆਂ ਨੇ ਜਿਵੇਂ ਕਿ ਸ ਸਲੰਡਰ ਨੂੰ ਹਮੇਸ਼ਾ ਖੁੱਲ੍ਹੇ ਜਾਂ ਐਸੇ ਕਮਰੇ ਵਿੱਚ ਰੱਖੀਏ ਜਿੱਥੇ ਖਿੜਕੀਆਂ ਦੇ ਦਰਵਾਜੇ ਖੁੱਲ੍ਹੇ ਹੋਣ ਅਤੇ ਸਲੰਡਰ ਨੂੰ ਜਿਹੜੀ ਵੀ ਜਗ੍ਹਾ 'ਤੇ ਰੱਖਣਾ ਹੋਵੇ ਉੱਥੇ ਇੱਕ ਜਗ੍ਹਾ ਜ਼ਿਆਦਾ ਹੋਣੀ ਚਾਹੀਦੀ ਹੈ ਤਾਂ ਕਿ ਪ੍ਰੈਸ਼ਰ ਰੈਗੂਲੇਟਰ ਦਾ ਨਾਭ ਅਤੇ ਰਬੜ ਦੀ ਟਰਬਿਊਨ ਨੂੰ ਹਿਲਾਉਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਇਹ ਤੋਂ ਇਲਾਵਾ ਸਲੰਡਰ ਨੂੰ ਹਮੇਸ਼ਾ ਸਿੱਧਾ ਰੱਖਣਾ ਚਾਹੀਦਾ ਹੈ ਅਤੇ ਉਸਦੀ ਵਲਬ ਉੱਪਰ ਨੂੰ ਕਰਕੇ ਰੱਖਣੀ ਚਾਹੀਦੀ ਹੈ ਤਾਂ ਜੋ ਸਲੈਂਡਬਤ ਇਹਨਾਂ ਨੁਕਸਾਨਾਂ ਤੋਂ ਬਚਿਆ ਜਾ ਸਕੇ